ਅਗਰ ਸਰਕਾਰ ਆਪਣਾ ਕੋਈ ਵੀ ਕਾਰੋਬਾਰ ਸ਼ੁਰੂ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਕੋਈ ਵੀ ਕਾਰੋਬਾਰ ਹੁੰਦਾ ਹੈ ਉਹ ਹੁੰਦਾ ਹੈ ਰੋਡ ਬਣਾਉਣ ਦਾ ਸਕੂਲ ਬਣਾਉਣ ਦਾ ਜਾਂ ਕੋਈ ਵੀ ਲੋਕਾਂ ਵਾਸਤੇ ਸਹਾਇਤਾ ਕਰਨ ਦਾ ਅਤੇ ਇਹ ਸਭ ਕਰਨ ਤੋਂ ਪਹਿਲਾਂ ਉਹ ਲੋਕਾਂ ਨੂੰ ਕਾਰੋਬਾਰ ਦਿੰਦੇ ਹਨ ਜਿਸ ਪ੍ਰਕਾਰ ਇੱਕ ਸਰਕਾਰ ਰੋਡ ਬਣਾਉਂਦੀ ਹੈ ਅਤੇ ਉਸ ਰੋਡ ਬਣਾਉਣ ਵਿੱਚ ਲੋਕਾਂ ਨੂੰ ਕੰਮ ਦਿੰਦੀ ਹੈ ਜਿਹੜੇ ਵੀ ਬੇਰੁਜ਼ਗਾਰ ਰਹਿੰਦੇ ਹੁੰਦੇ ਹਨ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਹੈ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਹਨ ਤਾਂ ਕਿ ਉਹ ਕੰਮ ਕਰਨ ਉਹ ਪੈਸੇ ਕਮਾਉਣ ਆਪਣੇ ਦੇਸ਼ ਦੀ ਜੀ ਡੀ ਪੀ ਨੂੰ ਅੱਗੇ ਅੱਗੇ ਵਧਾਉਣ ਜਿਸ ਕਾਰਨ ਸਾਡੇ ਦੇਸ਼ ਵਿੱਚ ਬਹੁਤ ਹੀ ਬਹੁਤ ਪੈਸਾ ਆਵੇ ਇਸ ਪ੍ਰਕਾਰ ਜਿੱਦਾਂ ਸਕੂਲ ਬਣਦੇ ਹਨ ਅਤੇ ਸਰਕਾਰੀ ਸਕੂਲ ਬਣਦੇ ਹਨ ਅਤੇ ਸਰਕਾਰ ਬੱਚਿਆਂ ਨੂੰ ਪੜ੍ਹਾਉਂਦੀ ਹੈ ਸਰਕਾਰ ਬੱਚਿਆਂ ਨੂੰ ਕਹਿੰਦੀ ਹੈ ਕਿ ਤੁਸੀਂ ਪੜ੍ਹੋ ਤੁਸੀਂ ਅੱਗੇ ਵਧੋ ਤੁਸੀਂ ਨਾਮ ਹਾਸਲ ਕਰੋ ਤੁਸੀਂ ਪੈਸੇ ਕਮਾਓ ਇਸ ਪ੍ਰਕਾਰ ਜਿੱਦਾਂ ਹੀ ਸਕੂਲ ਬਣਦਾ ਉੱਦਾਂ ਹੀ ਲੋਕਾਂ ਨੂੰ ਕੰਮ ਵੀ ਮਿਲਦਾ ਹੈ ਜਿਹੜੇ ਵੀ ਬੇਰੁਜ਼ਗਾਰ ਟੀਚਰਸ ਹੁੰਦੇ ਹਨ ਅਧਿਆਪਕ ਹੁੰਦੇ ਹਨ ਉਹਨਾਂ ਨੂੰ ਵੀ ਕੰਮ ਕਰਨ ਦੇ ਮੌਕਾ ਮਿਲਦਾ ਉਹ ਵੀ ਪੈਸੇ ਕਮਾ ਸਕਦੇ ਹਨ ਸਰਕਾਰੀ ਕੰਮਾਂ ਵਿੱਚ ਹਾਂ ਥੋੜ੍ਹੀ ਪਰੇਸ਼ਾਨੀ ਜ਼ਰੂਰ ਆਉਂਦੀ ਹੈ ਪਰ ਉਹਨਾਂ ਨੂੰ ਪੈਸਾ ਬਹੁਤ ਮਿਲਦਾ ਹੈ ਉਹ ਪੈਸੇ ਕਮਾ ਲੈਂਦੇ ਹਨ ਅਤੇ ਸਰਕਾਰ ਉਹਨਾਂ ਦੀ ਮਦਦ ਵੀ ਕਰਦੀ ਹੈ ਸਰਕਾਰ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਵੀ ਪ੍ਰੋਵਾਈਡ ਕਰਦੀ ਹੈ ਮਤਲਬ ਉਹਨਾਂ ਨੂੰ ਹੋਸਪਿਟਲ ਦਿੰਦੇ ਹਨ ਉਹਨਾਂ ਨੂੰ ਫਰੀ ਚੈੱਕਅਪ ਮਿਲਦਾ ਹੈ ਕਿ ਉਹ ਆਪਣੇ ਮਤਲਬ ਪੂਰੇ ਸਰੀਰ ਦੇ ਚੈੱਕਅਪ ਕਰਵਾ ਸਕਣ ਕੋਈ ਵੀ ਅਗਰ ਉਹਨਾਂ ਨੂੰ ਬਿਮਾਰੀ ਲੱਗਦੀ ਹੈ ਤਾਂ ਮਤਲਬ ਉਹ ਆਪਣੀ ਦਵਾਈ ਫਰੀ 'ਚ ਲੈ ਸਕਣ